ਹਾਂਜੀ ਬਾਈ ਜਿਵੇਂ ਕਿ ਤੁਹਾਨੂੰ ਅਸੀਂ ਚੰਡੀਗ੍ਹੜ ਲਈ ਬੁੱਕ ਕੀਤਾ ਤਾ ਜੀ ਤੁਹਾਡੀ ਟੈਕਸੀ ਨੂੰ ਜੀ ਉੱਥੇ ਆਪਾਂ ਘੁੰਮੇ ਫਿਰੇ ਰਸਤੇ ਵਿੱਚ ਵੀ ਆਰ ਮੋਲ ਵੀ ਗਏ ਸ਼ੌਪਿੰਗ ਕੀਤੀ ਫਿਲਮ ਫਿਲਮ ਵੀ ਦੇਖੀ ਕੈਰੀ ਓਨ ਜੱਟਾ ਜੋ ਕਿ ਬਹੁਤ ਹੀ ਵਧੀਆ ਸੀ ਰਸਤੇ ਵਿੱਚ ਆਪਾਂ ਨੇ ਰੋਟੀ ਵੀ ਖਾਧੀ ਢਾਬੇ ਤੋਂ ਜੋ ਕਿ ਬਹੁਤ ਹੀ ਵਧੀਆ ਸੀ ਅਤੇ ਤੁਸੀਂ ਵੀ ਖਾਧੀ ਆ ਜੀ ਅਤੇ ਮੇਰੀ ਫੈਮਲੀ ਮੇਰੇ ਨਾਲ ਸੀ ਜਿਸ ਨਾਲ ਕਿ ਮੈਨੂੰ ਕੋਈ ਵੀ ਪ੍ਰੌਬਲਮ ਨਹੀਂ ਆਈ ਤੁਹਾਡਾ ਸਰਵਿਸ ਬਹੁਤ ਵਧੀਆ ਲੱਗੀ ਅਤੇ ਮੇਰੇ ਕੋਲ ਹੁਣ ਸਾਰੇ ਪੈ ਜੋ ਕੈਸ਼ ਤਾ ਉਹ ਖਤਮ ਹੋ ਗਿਆ ਰਸਤੇ ਵਿੱਚ ਆਉਂਦੇ ਆਉਂਦੇ ਕਿਆ ਮੈਂ ਤੁਹਾਨੂੰ ਔਨਲਾਈਨ ਪੈਮੇਂਟ ਕਰ ਸਕਦਾ ਤੁਹਾਡਾ ਕੋਈ ਵੀ ਯੂ ਪੀ ਆਈ ਆਈ ਡੀ ਜਾਂ ਗੂਗਲ ਪੇਅ ਕਿਉਂਕਿ ਮੇਰੇ ਕੋਲ ਸਾਰੇ ਕੈਸ਼ ਤਾ ਜੋ ਖਤਮ ਹੋ ਗਿਆ ਜੇ ਤੁਹਾਡੇ ਕੋਲ ਕੋਈ ਤੁਹਾਡੀ ਐਪ ਆ ਗੂਗਲ ਪੇਅ ਜਾਂ ਔਨਲਾਈਨ ਭੁਗਤਾਨ ਮੈਂ ਕਰ ਸਕਦਾ ਹਾਂ ਅਤੇ ਤੁਹਾਡੀ ਸਰਵਿਸ ਬਹੁਤ ਵਧੀਆ ਲੱਗੀ ਧੰਨਵਾਦ ਜੀ